ਸਭ ਤੋਂ ਪਹਿਲਾਂ ਮੈਂ ਆਪਣੇ ਘਰ ਵਿੱਚ ਲੱਗੇ ਬਗੀਚੇ ਦੇ ਵਿੱਚ ਲੱਗੇ ਪਟੂਨੀਆਂ ਦੇ ਫੁੱਲਾਂ ਅਤੇ ਜੋ ਮੇਰੇ ਘਰ ਵਿੱਚ ਦੇ ਬਗੀਚੇ ਵਿੱਚ ਵੇਲ ਲੱਗੀ ਹੋਈ ਹੈ ਉਹਨਾਂ ਦੇ ਫੁੱਲਾਂ ਦੀ ਫੋਟੋ ਖਿੱਚੀ ਅਤੇ ਉਸ ਸਮੇਂ ਮੇਰੀ ਉਮਰ ਅਠਾਰਾਂ ਸਾਲ ਸੀ